ਸਾਡੇ ਪਿੰਡ ਦੇ ਬਜ਼ੁਰਗ ਬਹੁਤ ਕਾਰਨਾਂ ਕਰਕੇ ਮੰਜੇ ਉੱਤੇ ਪੈ ਜਾਂਦੇ ਹਨ ਉਹਨਾਂ ਦੀ ਸਿਹਤ ਖਰਾਬ ਹੋਣਾ ਸਭ ਤੋਂ ਮੁੱਖ ਕਾਰਨ ਹੈ ਸਿਹਤ ਵਿੱਚ ਕਈਆਂ ਨੂੰ ਡਾਇਬਿਟੀਜ਼ ਹੈ ਜਿਹਨੂੰ ਆਮ ਭਾਸ਼ਾ ਵਿੱਚ ਸ਼ੁਗਰ ਹੋਣਾ ਵੀ ਕਹਿੰਦੇ ਹਨ ਅਤੇ ਕਈਆਂ ਨੂੰ ਨੋ ਨੋਰਮਲ ਬੁਢਾਪੇ ਦੀ ਦਿੱਕਤ ਜਿਵੇਂ ਕਿ ਸਰੀਰ ਦਾ ਦੁਖਣਾ ਅੱਖਾਂ 'ਚੋਂ ਘੱਟ ਦਿਖਣਾਂ ਇਹਨਾਂ ਸਭ ਕਾਰਨਾਂ ਕਰਕੇ ਵੀ ਕਈ ਬਜ਼ੁਰਗ ਸਾਡੇ ਪਿੰਡ ਦੇ ਮੰਜੇ ਉੱਤੇ ਬਹਿ ਜਾਂਦੇ ਹਨ ਨਾਲੇ ਉਹਨਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਦੀ ਦੇਖਭਾਲ ਕਰਦੇ ਹਨ ਪਰਿਵਾਰਿਕ ਮੈਂਬਰ ਉਹਨਾਂ ਦੀ ਦੇਖਭਾਲ ਕਰਦੇ ਹਨ ਜਿਵੇਂ ਕਿ ਭਾਵੇਂ ਕਦ ਕਈ ਉਹਨਾਂ ਨੂੰ ਹੋਸਪਿਟਲ ਐਡਮਿਟ ਕਰਵਾ ਦਿੰਦੇ ਹਨ ਕਈ ਹੋਸਪਿਟਲਾਂ ਵਿੱਚ ਜਿਹੜੇ ਨਰਸ ਹੁੰਦੇ ਹਨ ਉਹਨਾਂ ਨੂੰ ਹੀ ਘਰ ਵਿੱਚ ਲਿਆਉਂਦੇ ਹਨ ਸਾਡੇ ਇੱਥੇ ਇੱਕ ਬਜ਼ੁਰਗ ਹਨ ਜਿਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਸੀ ਅਸਲ ਵਿੱਚ ਉਹਨਾਂ ਨੂੰ ਮਲੇਰੀਆ ਡੇਂਗੂ ਹੋ ਗਿਆ ਸੀ ਜਿਹਨਾਂ ਜਿਸ ਕਰਕੇ ਉਹ ਹੋਸਪਿਟਲ ਵਿੱਚ ਐਡਮਿਟ ਹੋਈ ਸੀ ਉਹਨਾਂ ਦੇ ਇੱਕ ਡ੍ਰਿਪ ਲੱਗੀ ਸੀ ਪਰ ਬਾਅਦ ਵਿੱਚ ਬਹੁਤ ਹੀ ਜ਼ਿਆਦਾ ਬੇਹੋਸ਼ੀ ਦੇ ਕਾਰਨ ਉਹਨਾਂ ਨੂੰ ਦੋ ਤਿੰਨ ਡ੍ਰਿਪ ਲਗਾ ਦਿੱਤੀਆਂ ਗਈਆਂ ਸਨ ਜਦੋਂ ਉਹ ਥੋੜ੍ਹੇ ਸਹੀ ਹੋਏ ਉਹਨਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਨੂੰ ਆਪਣੇ ਘਰ ਲੈ ਆਏ ਅਤੇ ਨਾਲ ਹੀ ਇੱਕ ਨਰਸ ਨੂੰ ਵੀ ਘਰ ਲੈ ਆਏ ਇਸ ਦੇ ਨਾਲ ਉਹਨਾਂ ਦੀ ਦੇਖਭਾਲ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਨਾਲੇ ਇੱਕ ਐਕਸਪਰਟ ਦੇ ਨਾਲ ਰੱਖਣ ਨਾ ਕਰਕੇ ਉਹਨਾਂ ਦੇ ਇੰਜੈਕਸ਼ਨ ਵਗੈਰਾ ਵਿੱਚ ਵੀ ਕੋਈ ਦਿੱਕਤ ਨਹੀਂ ਆਈ